ਗੁਡ ਈਵਨਿੰਗ ਜੀ ਕੌਣ ਬੋਲਦੇ ਸੀ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਪਹਿਲੀ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਡਾਇਟ ਸਹੀ ਲੈ ਰਹੇ ਹੋ ਹਾਂਜੀ ਡਾਇਟ ਸਹੀ ਲੈਣੀ ਆ ਅਤੇ ਉਸ ਤੋਂ ਬਾਅਦ ਯੋਗਾ ਮਤਲਬ ਯੋਗਾ ਕਰਨਾ ਹੌਲੀ ਹੌਲੀ ਕਰਨਾ ਸ਼ੁਰੂ ਕਰੋਗੇ ਅਤੇ ਤੁਹਾਨੂੰ ਸ਼ੁਰੂ ਵਿੱਚ ਕੁਝ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਪਰ ਹੌਲੀ ਹੌਲੀ ਜਾ ਕੇ ਸਭ ਸਹੀ ਹੋਣਾ ਸ਼ੁਰੂ ਹੋ ਜੇਗਾ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਲੱਤਾਂ ਦਰਦ ਹੁੰਦੀਆਂ ਤੁਹਾਡੀ ਕਮਰ ਦਰਦ ਹੁੰਦੀ ਆ ਹਾਂਜੀ ਅਤੇ ਤੁਸੀਂ ਰੋਜ਼ ਮਤਲਬ ਸਵੇਰੇ ਆਪਦਾ ਸਵੇਰੇ ਸ਼ਾਮ ਜਦੋਂ ਵੀ ਤੁਹਾਡਾ ਟਾਈਮ ਲੱਗੇ ਜ਼ਰੂਰ ਟਾਈਮ ਨਿਕਾਲਣਾ ਏ ਕਰਨਾ ਹੈ ਹਾਂਜੀ ਇਹਦੇ ਨਾਲ ਇੱਕ ਤਾਂ ਤੁਹਾਡੀ ਲੱਤਾਂ ਵੀ ਸਹੀ ਹੋ ਜਾਣਗੀਆਂ ਤੁਹਾਡੇ ਕਮਰ ਦਾ ਦਰਦ ਵੀ ਸਹੀ ਹੋ ਜਾਏਗਾ

ਨਹੀਂ ਨਹੀਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਇੱਕ ਵਾਰ ਸ਼ੁਰੂਆਤ ਵਿੱਚ ਤੁਹਾਨੂੰ ਮੁਸ਼ਕਿਲ ਆ ਸਕਦੀ ਪਰ ਹੌਲੀ ਹੌਲੀ ਜਾ ਕੇ ਸਭ ਸਹੀ ਹੋ ਜੇਗਾ ਜਿੰਨੀ ਦੇਰ ਤੱਕ ਤੁਸੀਂ ਵਧੀਆ ਕਰ ਸਕਦੇ ਹੋ ਇਹ ਨਹੀਂ ਵੀ ਇੱਕ ਵਾਰ ਸ਼ੁਰੂ ਕਰਕੇ ਫਿਰ ਵਿੱਚੋਂ ਕੁਝ ਦਿਨ ਛੱਡਤਾ ਅਤੇ ਫਿਰ ਦੁਬਾਰਾ ਕਰ ਲਿਆ ਸ਼ੁਰੂ ਹਾਂਜੀ ਇਹ ਕੰਮ ਨਹੀਂ ਕਰਨਾ ਲਗਾਤਾਰ ਕਰਨਾ ਯੋਗਾ ਹਾਂਜੀ ਇਹਦੇ ਨਾਲ ਤੁਹਾਨੂੰ ਜਿਹੜੀਆਂ ਵੀ ਦਿੱਕਤਾਂ ਆ ਰਹੀਆਂ ਨੇ ਸਾਰੀਆਂ ਦਿੱਕਤਾਂ ਤੁਹਾਡੀਆਂ ਸਹੀ ਹੋ ਜਾਣਗੀਆਂ ਨਹੀਂ ਨਹੀਂ ਖਾਣਾ ਖਾਣ ਤੋਂ ਪਹਿਲਾਂ ਹੀ ਕਰਨਾ ਯੋਗਾ ਹਾਂਜੀ ਜੀ ਆਪਾਂ ਹਾਂਜੀ ਬਹੁਤ ਬਹੁਤ ਬੈਨੀਫਿਟ ਹੁੰਦੇ ਨੇ ਯੋਗਾ ਕਰਨ ਦੇ ਜਿਵੇਂ ਇੱਕ ਤਾਂ ਤੁਹਾਡੇ ਸਰੀਰ ਮਤਲਬ ਤਨਾਅ ਮੁਕਤ ਹੋਏਗਾ ਜਦੋਂ ਸਵੇਰੇ ਤੁਹਾਡਾ ਯੋਗਾ ਕਰੋਗੇ ਤੁਸੀਂ ਵਧੀਆ ਧਿਆਨ ਲਗਾਓਗੇ ਤਾਂ ਅਤੇ ਯੋਗਾ ਦੇ ਲਈ ਟਾਈਮ ਜ਼ਰੂਰ ਨਿਕਾਲਣਾ ਸਵੇਰੇ ਸ਼ਾਮ ਹੋਰ ਵੀ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੋਈ ਤੁਸੀਂ ਪੁੱਛ ਸਕਦੇ ਹੋ ਹਾਂਜੀ ਅਤੇ ਹੋਰ ਵੀ ਬਹੁਤ ਫਾਇਦੇ ਹੈਗੇ ਨੇ ਇੱਕ ਤਾਂ ਸਰੀਰ ਹੀ ਆਪਣਾ ਬਿਮਾਰੀਆਂ ਤੋਂ ਦੂਰ ਰਹਿੰਦਾ ਅਤੇ ਦੂਸਰਾ ਤੁਹਾਡੇ ਜਿਹੜੀਆਂ ਵੀ ਤੁਹਾਨੂੰ ਬਿਮਾਰੀਆਂ ਜਾਂ ਕਹਿ ਸਕਦੇ ਹਾਂ ਕਮਰ ਦਰਦ ਲੱਤਾਂ ਦਰਦ ਜੋ ਵੀ ਹੁੰਦਾ ਇਹ ਵੀ ਤੁਹਾਡਾ ਹੌਲੀ ਹੌਲੀ ਸਹੀ ਹੋ ਜਾਏਗਾ ਕਿਉਂਕਿ ਆਪਾਂ ਜਿਹੜੀ ਵੈਸੇ ਵੀ ਦਵਾਈਆਂ ਲੈਂਦੇ ਹਾਂ ਉਹ ਆਪਣੇ ਸਰੀਰ ਨੂੰ ਨੁਕਸਾਨ ਹੀ ਪਹੁੰਚਾਉਂਦੀਆਂ ਨੇ ਹਾਂਜੀ ਜ਼ਰੂਰ ਜੀ ਥੈਂਕ ਯੂ ਕੋਈ ਨਹੀਂ